ਬਾਲ ਮਜ਼ਦੂਰੀ ਦੀ ਸਮੱਸਿਆ ਸ਼ੁਰੂ ਤੋਂ ਇੱਕ ਬਹੁਤ ਵੱਡੀ ਸਮੱਸਿਆ ਰਹੀ ਹੈਗੀ ਜ਼ਿਆਦਾਤਰ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ 'ਚ ਦੇਖਦੇ ਹਾਂ ਕਿ ਜਿਹੜੇ ਬੱਚੇ ਐਗੇ ਗਰੀਬ ਵਰਗ ਦੇ ਨਾਲ ਸੰਬੰਧਿਤ ਵਿਅਕਤੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਉਹ ਆਪਣੇ ਬੱਚਿਆਂ ਨੂੰ ਆਪਣੇ ਨਾਲ ਕੰਮ 'ਤੇ ਲੈ ਜਾਂਦੇ ਹਨ ਇਸ ਕਾਰਨ ਜਿਹੜਾ ਜਿਸ ਜਿਹੜੀ ਉਮਰ ਬੱਚਿਆਂ ਦੇ ਪੜ੍ਹਨ ਦੀ ਹੁੰਦੀ ਆ ਉਸ ਉਮਰ ਦੇ ਵਿੱਚ ਉਹ ਜਾ ਕੇ ਆਪਣੇ ਮਾਤਾ ਪਿਤਾ ਦੇ ਨਾਲ ਕੰਮ ਕਰਵਾਉਂਦੇ ਹਨ ਇਸ ਨਾਲ ਹੁੰਦਾ ਕੀ ਹੈ ਕਿ ਬੱਚੇ ਦਾ ਵਿਕਾਸ ਉਹ ਵੀ ਰੁਕ ਜਾਂਦਾ ਅਤੇ ਬੱਚਾ ਪੜ੍ਹ ਨਹੀਂ ਸਕਦਾ ਗਾ ਤਾਂ ਜਿੱਥੇ ਇਸ ਦੇ ਵਿੱਚ ਸਾਨੂੰ ਇਸ ਨੂੰ ਰੋਕਣ ਦੇ ਲਈ ਇੱਕ ਸਰਕਾਰ ਨੂੰ ਚਾਹੀਦਾ ਇੱਕ ਕਾਨੂੰਨ ਬਣਾਇਆ ਜਾਵੇ ਜਿਸ ਦੇ ਤਹਿਤ ਆ ਜਿਹੜੀ ਬਾਲ ਮਜ਼ਦੂਰੀ ਹੈ ਜਿਹੜੀ ਉਹ ਰੁਕ ਸਕੇ ਅਤੇ ਜਿਹੜੇ ਬੱਚੇ ਹੈਗੇ ਉਹ ਆਪਣੇ ਪੜ੍ਹਾਈ ਕਨੀ ਧਿਆਨ ਦੇ ਸਕਣ ਤੇ ਜਿਹੜੀ ਮਾਤਾ ਪਿਤਾ ਗੇ ਉਹ ਵੀ ਆਪਣੇ ਬੱਚਿਆਂ ਨੂੰ ਮਜ਼ਦੂਰੀ 'ਤੇ ਲਿਜਾਣ ਦੀ ਥਾਂ 'ਤੇ ਉਹਨਾਂ ਨੂੰ ਸਕੂਲ ਦੇ ਵਿੱਚ ਭੇਜਣ ਜਿੱਥੇ ਉਹਨਾਂ ਦਾ ਇੱਕ ਸੰਪੂਰਨ ਆ ਜਿਹੜਾ ਵਿਕਾਸ ਹੋ ਸਕੇ ਜ਼ਿਆਦਾਤਰ ਜਿਹੜੀ ਬੱਚੇ ਹੈਗੇ ਉਹ ਜ਼ਿਆਦਾਤਰ ਆਪਣੇ ਮਾਤਾ ਪਿਤਾ ਦੇ ਨਾਲ ਕੋਈ ਦਿਹਾੜੀ ਕਰਨ ਜਾਂਦਾ ਰੁਜ਼ਗਾਰ ਕਰਨ ਲਈ ਜਾਂਦਾ ਉੱਥੇ ਚਲੇ ਜਾਂਦੇ ਹਨ ਜਾਂ ਬਹੁਤ ਜ਼ਿਆਦਾ ਫੈਕਟਰੀਆਂ ਅਜਿਹੀਆਂ ਹਨ ਜਿੱਥੇ ਅ ਬੱਚਿਆਂ ਨੂੰ ਜਿਹੜਾ ਕੰਮ 'ਤੇ ਕੰਮ ਕਰਵਾਇਆ ਜਾਂਦਾ ਗਾ ਇਹ ਬੱਚੇ ਆ ਜਿਹੜੇ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਕੋਈ ਸਾਧਨ ਨਹੀਂ ਹੁੰਦਾ ਹੈਗਾ ਉਹ ਬੱਚੇ ਆ ਜਿਹੜੇ ਆਪਣੇ ਮਾਤਾ ਪਿਤਾ ਨਹੀਂ ਹੁੰਦੇ ਉਹ ਬੱਚੇ ਜ਼ਿਆਦਾਤਰ ਮਤਲਬ ਰੁਜ਼ਗਾਰ ਦੇ ਲਈ ਜਾਂ ਆਪਣੇ ਘਰ ਦੀ ਰੋਟੀ ਕਮਾਉਣ ਦੇ ਲਈ ਤਾਂ ਉਹ ਬੱਚੇ ਫੈਕਟਰੀਆਂ 'ਚ ਕੰਮ ਕਰਦੇ ਹਨ ਤਾਂ ਅਜਿਹੇ ਲਈ ਸਰਕਾਰ ਆ ਜਿਹੜੀ ਉਹਨਾਂ ਨੂੰ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈਗੀ ਬੱਚਿਆਂ ਨੂੰ ਜਿਹੜੀ ਫੈਲੋਸ਼ਿਪ ਦੇਣੀ ਚਾਹੀਦੀ ਉਹਨਾਂ ਨੂੰ ਵਜੀਫਾ ਦੇਣਾ ਚਾਹੀਦਾ ਹੈਗਾ ਤਾਂ ਜੋ ਉਹ ਬੱਚੇ ਆ ਜਿਹੜੇ ਆਪਣੀ ਪੜ੍ਹਾਈ ਦਾ ਕੰਮ ਜਾਰੀ ਰੱਖ ਸਕਣ ਅਤੇ ਆਪਣੇ ਇੱਕ ਸੰਪੂਰਨ ਵਿਅਕਤੀਤਵ ਦਾ ਵਿਕਾਸ ਕਰ ਸਕਣ